ਜੀਵਨ ਵਿੱਚ ਕਿਸੇ ਵੀ ਸ਼ੁਭ ਘਟਨਾ ਜਾਂ ਸ਼ੁਭ ਕੰਮ ਦੀ ਸ਼ੁਰੂਆਤ ਰੱਬ ਦਾ ਨਾਮ ਲੈ ਕੇ ਕਰਨੀ ਚਾਹੀਦੀ ਹੈ ਰੱਬ ਦਾ ਸ਼ੁਕਰਾਨਾ ਹਰ ਸਥਿਤੀ ਵਿੱਚ ਜ਼ਰੂਰੀ ਹੈ ਅਸੀਂ ਆਪਣੇ ਜੀਵਨ ਵਿੱਚ ਕਿਸੇ ਵੀ ਸ਼ੁਭ ਘਟਨਾ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਪਾਠ ਕਰਕੇ ਸ਼ੁਰੂ ਕਰਦੇ ਹਾਂ ਕਿਉਂਕਿ ਜਿਸ ਕੰਮ ਦੇ ਵਿੱਚ ਰੱਬ ਸਹਾਈ ਹੁੰਦਾ ਹੈ ਉਹੀ ਕੰਮ ਸਿਰੇ ਚੜ੍ਹਦਾ ਹੈ